ਹਾਂਜੀ ਭੰਗੜਾ ਪਾਉਣ ਵਾਲੇ ਸਿੱਖਣ ਦੀ ਦਿਲਚਸਪੀ ਰੱਖਦੇ ਹੋਏ ਭੰਗੜੇ ਵਾਲੇ ਵਿਅਕਤੀ ਨੂੰ ਅਸੀਂ ਮੈਂ ਸਲਾਹ ਦੇਣਾ ਚਾਹਾਂਗੀ ਕਿ ਸਭ ਤੋਂ ਪਹਿਲਾਂ ਤਾਂ ਉਸ ਨੂੰ ਭੰਗੜੇ ਦਾ ਇਤਿਹਾਸ ਪਤਾ ਹੋਣਾ ਚਾਹੀਦਾ ਹੈ ਕਿ ਭੰਗੜਾ ਕਿਸ ਭਾਵਨਾ ਨਾਲ ਜੁੜਿਆ ਹੈ ਅਤੇ ਦੂਸਰਾ ਕਿ ਇਹ ਭੰਗੜਾ ਸਿੱਖਣ ਦੇ ਨਾਲ ਨਾਲ ਉਸ ਵਿਅਕਤੀ ਦੀ ਅੰਦਰੋਂ ਦਿਮਾਗੀ ਤੌਰ 'ਤੇ ਵੀ ਰਿਲੈਕਸ ਫੀਲ ਕਰਦਾ ਹੈ ਅਤੇ ਇਹ ਇੱਕ ਬਹੁਤ ਹੀ ਵਧੀਆ ਐਕਸਰਸਾਈਜ਼ ਜਾਂ ਕਸਰਤ ਮੰਨੀ ਜਾਂਦੀ ਹੈ ਅਤੇ ਪਹਿਲਾਂ ਜਦੋਂ ਆਪਾਂ ਭੰਗੜਾ ਸਿੱਖਣਾ ਸ਼ੁਰੂ ਕਰਦੇ ਹਾਂ ਤਾਂ ਹੋਸ਼ੋ ਹੁਲਾਸ ਦੇ ਨਾਲ ਸਿੱਖਦੇ ਹਾਂ ਔਰ ਇਸ ਨੂੰ ਸਿੱਖਣ ਦੇ ਨਾਲ ਨਾਲ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਇੱਕ ਬਹੁਤ ਵਧੀਆ ਕਸਰਤ ਹੈ ਤਾਂ ਪਹਿਲੇ ਹਫਤੇ ਦੇ ਵਿੱਚ ਜਿਵੇਂ ਪਹਿਲਾਂ ਦੋ ਦਿਨ ਹੀ ਕਰਨਾ ਚਾਹੀਦਾ ਕਿਉਂਕਿ ਇਹ ਬਹੁਤ ਹੀ ਹੋਸ਼ੋ ਹੁਲਾਸ ਦੇ ਨਾਲ ਆਪਾਂ ਜਦੋਂ ਕਰਦੇ ਹਾਂ ਤਾਂ ਆਪਣੀ ਸਰੀਰ ਦੀ ਕਸਰਤ ਹੁੰਦੀ ਹੈ ਅਤੇ ਸਰੀਰ ਥੱਕ ਜਾਂਦਾ ਹੈ ਔਰ ਇਸ ਨਾਲ ਸਾਡਾ ਤਨ ਅਤੇ ਮਨ ਦੋਨੋ ਹੀ ਰਿਲੈਕਸ ਹੁੰਦੇ ਹਨ ਅਤੇ ਪੂਰੇ ਖੁਸ਼ ਹੋ ਕੇ ਹੀ ਇਹ ਭੰਗੜਾ ਪਾਇਆ ਜਾਂਦਾ ਹੈ ਅਤੇ ਇਹ ਪੰਜਾਬ ਦਾ ਸਭ ਤੋਂ ਵਧੀਆ ਪਹਿਲੇ ਨੰਬਰ ਦਾ ਲੋਕ ਨਾਚ ਰਹਿ ਚੁੱਕਿਆ ਹੈ ਇਸ ਵਿੱਚ ਹਰ ਤਰ੍ਹਾਂ ਦੇ ਲੋਕ ਭੰਗੜੇ ਦੇ ਵਿੱਚ ਆ ਕੇ ਆਪਣਾ ਆਨੰਦ ਮਾਣਦੇ ਹਨ ਅਤੇ ਦਿਮਾਗੀ ਤੌਰ 'ਤੇ ਬਹੁਤ ਅਤੇ ਸਰੀਰਕ ਤੌਰ 'ਤੇ ਮਜ਼ਬੂਤ ਹੁੰਦੇ ਹਨ